ਬਜ਼ੁਰਗ ਲੋਕ ਕਈ ਕਿਸਮ ਦੀਆਂ ਖੇਡਾਂ ਖੇਡਦੇ ਹਨ ਜਿਵੇਂ ਕਿ ਸਾਡੇ ਪੁਰਾਣੇ ਬਜ਼ੁਰਗ ਨੇ ਜੋ ਸ਼ਾਮ ਨੂੰ ਆਪਣੇ ਪਿੰਡ ਦੀ ਸੱਥ 'ਤੇ ਇਕੱਠੇ ਹੁੰਦੇ ਹਨ ਇਕੱਠੇ ਰਲ ਕੇ ਬੈਠਦੇ ਹਨ ਉੱਥੇ ਉਹ ਸਾਰੇ ਜਣੇ ਬੈਠ ਕੇ ਰਲ ਕੇ ਤਾਸ਼ ਖੇਡਦੇ ਹਨ ਤਾਸ਼ ਉਹਨਾਂ ਦੀ ਬਹੁਤ ਹੀ ਮਨੋਰੰਜਨ ਵਾਲੀ ਖੇਡ ਹੈ ਉਹ ਖੇਡ ਦੇ ਨਾਲ਼ ਨਾਲ਼ ਆਪਣਾ ਮਨੋਰੰਜਨ ਕਰਦੇ ਹਨ ਇਸ ਤੋਂ ਇਲਾਵਾ ਪੁਰਾਣੇ ਬਜ਼ੁਰਗ ਸ਼ੈਰੋ ਸ਼ਾਇਰੀ ਵੀ ਖੇਡਦੇ ਹਨ ਇੱਕ ਦੂਜੇ ਨੂੰ ਚੁਟਕਲੇ ਸ ਸੁਣਾਉਂਦੇ ਹਨ ਗਜ਼ਲਾਂ ਵੀ ਬਜ਼ੁਰਗਾਂ ਦੀ ਪੁਰਾਣੀ ਖੇਡ ਹਨ ਮਨੋਰੰਜਨ ਦਾ ਸਾਧਨ ਹਨ ਸ਼ਤਰੰਜ ਖੇਡਦੇ ਹਨ ਹੋਰ ਕਈ ਤਰ੍ਹਾਂ ਦੇ ਛੋਟੇ ਮੋਟੇ ਮੁਕਾਬਲੇ ਕਰਦੇ ਹਨ ਬਜ਼ੁਰਗ ਜ਼ਿਆਦਾਤਰ ਤਾਸ਼ ਖੇਡਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਤਾਸ਼ ਖੇਡਣ ਦੇ ਨਾਲ਼ ਨਾਲ਼ ਉਹ ਗੱਪਾਂ ਮਾਰਦੇ ਹਨ ਗੱਪਾਂ ਮਾਰਨ ਦੇ ਨਾਲ਼ ਨਾਲ਼ ਉਹਨਾਂ ਦਾ ਮਨੋਰੰਜਨ ਦਾ ਸਾਧਨ ਬਣਦੀਆਂ ਹਨ ਮਨੋਰੰਜਨ ਕਰਨ ਦੇ ਤਰੀਕੇ ਉਹ ਆਪਣਾ ਖੇਡ ਖੇਡਦੇ ਹਨ ਬਜ਼ੁਰਗ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ